ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ ਤੇ ਮੁੰਡੇ ਚਿੱਟੇ ਕੁੜਤੇ ਪਜਾਮੇ ਕੁੜਤੇ ਰੰਗ ਬਰੰਗੀਆਂ ਲੁੰਗੀਆਂ ਪਹਿਨਦੇ ਹਨ ਭੰਗੜਾ ਕਰਨ ਵਾਲੇ ਮੁੰਡੇ ਗਲਿਆਂ ਵਿੱਚ ਕੈਂਠੇ ਹੱਥਾਂ ਵਿੱਚ ਡਾਂਗਾ ਸਿਰਾਂ ਉੱਤੇ ਰੰਗਲੀਆਂ ਪੱਗਾਂ ਅਤੇ ਪੈਰਾਂ ਵਿੱਚ ਜੁੱਤੀਆਂ ਪਾਉਂਦੇ ਹਨ ਇਹਨਾਂ ਚੀਜ਼ਾਂ ਨਾਲ ਭੰਗੜਾ ਬਹੁਤ ਹੀ ਜ਼ਿਆਦਾ ਅਟਰੈਕਟਿਵ ਲੱਗਦਾ ਹੈ ਜਿਵੇਂ ਕਿ ਭੰਗੜਾ ਮੁੱਢ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਤੇ ਇਹ ਪੰਜਾਬ ਦੇ ਵਿੱਚ ਹਜੇ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਹਨ ਭੰਗੜਾ ਇੱਕ ਉਹ ਚੀਜ਼ ਹੈ ਜਿਸ ਵਿੱਚ ਬਹੁਤ ਹੀ ਰੰਗ ਬਰੰਗੀਆਂ ਪੋਸ਼ਾਕਾਂ ਪਾਈ ਜਾਂਦੀਆਂ ਹਨ ਭੰਗੜਾ ਕੀ ਬਹੁਤ ਹੀ ਜ਼ਿਆਦਾ ਕਿਸਮਾਂ ਵਿੱਚ ਹੁੰਦਾ ਹੈ ਜਿਵੇਂ ਲੁੱਡੀ ਧਮਾਲ ਇਹ ਚੀਜ਼ਾਂ ਬਹੁਤ ਹੀ ਵਧੀਆ ਲੱਗਦੀਆਂ ਹਨ ਭੰਗੜਾ ਕਰਨ ਵਾਲੇ ਮੁੰਡਿਆਂ ਦੀ ਹਾਈਟ ਵੀ ਬਹੁਤ ਉੱਚੀ ਲੰਬੀ ਹੁੰਦੀ ਹੈ ਜੋ ਕਿ ਭੰਗੜੇ ਬਹੁਤ ਹੀ ਵਧੀਆ ਲੱਗਦੇ ਹਨ